ਹਾਂਜੀ ਬੋਲੀਏ ਨਮਸ਼ਕਾਰ ਜੀ ਸਾਡੇ ਸਰ ਸਿਰਫ਼ ਪਲੇਸਮੈਂਟ ਸਰਵਿਸ ਪ੍ਰੋਵਾਈਡ ਕਰਦੇ ਹਾਂ ਐਡਮਿਸ਼ਨ ਦਾ ਕੰਮ ਨਹੀਂ ਹੈਗਾ ਅਤੇ ਤੁਸੀਂ ਮੈਨੂੰ ਆਪਣੇ ਬਾਰੇ ਥੋੜ੍ਹੀਆਂ ਪਰਸਨਲ ਡਿਟੇਲਜ਼ ਦੱਸ ਦਿਓ ਤੁਹਾਡੀ ਹਾਈਐਸਟ ਕੁਆਲੀਫਿਕੇਸ਼ਨ ਕੀ ਹੈ ਕਿਹੜੇ ਸਾਲ 'ਚ ਕੀਤੀ ਹੈ ਤੁਸੀਂ ਠੀਕ ਹੈ ਜੀ ਕਿਹੜੀ ਯੂਨੀਵਰਸਿਟੀ ਤੋਂ ਕੀਤੀ ਹੈ ਤੁਸੀਂ ਹਮ ਤੁਹਾਡਾ ਕੋਈ ਵਰਕ ਐਕਸਪੀਰੀਅੰਸ ਹੈਗਾ ਤੁਹਾਡੀ ਕੋਈ ਪ੍ਰੈਫਰੈਂਸ ਹੈ ਕਿ ਕਿਹੜੀ ਫੀਲਡ ਦੇ ਵਿੱਚ ਕਿਸ ਪ੍ਰੋਫਾਈਲ ਦੇ ਉੱਤੇ ਜੋਬ ਕਰਨਾ ਚਾਹੁੰਦੇ ਹੋ ਅਦਾਬ ਡਿਵੈਲਪਮੈਂਟ ਦੇ ਵਿੱਚ ਸਾਡੇ ਕੋਲ ਤਿੰਨ ਪੋਸਟ ਹੈਗੀਆਂ ਨੇ ਇਹਦੇ ਵਿੱਚ ਇੱਕ ਜਿਹੜੀ ਹੈਗੀ ਉਹ ਫਰੰਟ ਐਂਡ ਦੇ ਵਿੱਚ ਹੀ ਹੈਗੀ ਇੱਕ ਬੈਕ ਐਂਡ ਦੇ ਵਿੱਚ ਉਹਦੇ ਵਿੱਚ ਤੁਸੀਂ ਕੀ ਪ੍ਰੈਫਰ ਕਰੋਗੇ ਠੀਕ ਹੈ ਜੀ ਆਪਣੇ ਸਾਡੇ ਕੋਲ ਡਿਜ਼ਾਇਨ ਵੀ ਇੱਕ ਰਿਕੁਇਰਮੈਂਟ ਹੈਗੀ ਹੈ ਇੱਕ ਕੰਪਨੀ ਵਾਸਤੇ ਉਹਦੇ ਵਿੱਚ ਵੀਹ ਹਜ਼ਾਰ ਰੁਪਿਆ ਤਨਖਾਹ ਹੈ ਅਤੇ ਅਗਰ ਤੁਸੀਂ ਇੰਟਰਸਟਿਡ ਹੋ ਤਾਂ ਤੁਸੀਂ ਸਾਨੂੰ ਦੱਸ ਦਿਓ ਫਿਰ ਅਸੀਂ ਤੁਹਾਡਾ ਇੱਕ ਟੈਸਟ ਕੰਡਕਟ ਕਰਾ ਕੇ ਉਹਨਾਂ ਨਾਲ ਗੱਲ ਕਰਾ ਦਿਆਂਗੇ ਠੀਕ ਹੈ ਜੀ ਉਹ ਮੈਂ ਦੱਸ ਦਿਆਂਗਾ ਤੁਹਾਨੂੰ ਬਾਅਦ 'ਚ